ਬਾਬਾ ਬੁੱਢਾ ਸਾਹਿਬ ਜੀ ਸ ਇੱਕ ਇਤਿਹਾਸਿਕ ਗੁਰਦੁਆਰਾ ਹੈ ਇੱਥੇ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਅਤੇ ਗੰਢੇ ਲੈ ਕੇ ਬਾਬਾ ਖੜਕ ਸਿੰਘ ਜੀ ਦੇ ਕੋਲ ਆਏ ਸਨ ਉਹਨਾਂ ਨੇ ਉਹਨਾਂ ਨੂੰ ਪੁੱਤਰ ਦਾ ਵਰਦਾਨ ਦਿੱਤਾ ਸੀ ਇਸ ਕਰਕੇ ਸੰਗਤਾਂ ਹੁਣ ਵੀ ਇਸ ਦਰ 'ਤੇ ਮਿੱਸੇ ਪ੍ਰਸ਼ਾਦੇ ਅਤੇ ਗੰਢੇ ਲੈ ਕੇ ਆਉਂਦੀਆਂ ਸਨ ਝੂਲਣਾ ਮਹਿਲ ਇਕ ਇਤਿਹਾਸਿਕ ਗੁਰਦੁਆਰਾ ਹੈ ਇਸ ਗੁਰੂ ਗੁਰੂ ਜੀ ਨੇ ਕੰਧ ਨੂੰ ਵਰਦਾਨ ਦਿੱਤਾ ਸੀ ਕਿ ਜੁਗਾਂ ਜੁਗਾਂ ਤੱਕ ਇਸ ਤਰ੍ਹਾਂ ਝੂਲਦੀ ਰਹੇਗੀ ਇਸ ਕੰਧ 'ਤੇ ਸੰਗਤ ਬੈਠਦੀ ਹੈ ਅਤੇ ਬਾਬਾ ਜੀ ਪਾਠ ਕਰਕੇ ਇਸ ਕੰਧ ਨੂੰ ਝੂਲਾ ਦਿੰਦੇ ਹਨ ਫਿਰ ਇਹ ਕੰਧ ਆਪਣੇ ਆਪ ਹਿੱਲਦੀ ਰਹਿੰਦੀ ਹੈ ਜਿਵੇਂ ਕਿ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਪਾਠ ਕੀਤਾ ਸੀ ਅਤੇ ਸਭ ਇਤਿਹਾਸਿਕ ਸਰੋਵਰਾਂ ਵਿੱਚੋਂ ਵੱਡਾ ਸਰੋਵਰ ਤਿਆਰ ਕੀਤਾ ਸੀ ਇੱਥੇ ਮਹੀਨੇ ਦੇ ਮਹੀਨੇ ਮੱਸਿਆ ਮਨਾਈ ਜਾਂਦੀ ਹੈ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਦਾ ਗੁਰਦੁਆਰਾ ਹੈ ਇਸ ਮੁਗਲਾਂ ਰਾਹੀਂ ਰਸਤੇ ਦਾ ਚਲਾਣ ਕੀਤਾ ਜਾਂਦਾ ਸੀ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਨੇ ਇਸ ਦਾ ਵਿਰੋਧ ਕੀਤਾ ਸੀ